ਆਪਣੇ ਇਤਿਹਾਸ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਪਹਿਲਾਂ ਪਿਓਰ ਪੰਜਾਬੀ ਹੁੰਦੀ ਸੀਗੀ ਅਤੇ ਇਹ ਆਪਣੇ ਗੁਰੂਆਂ ਦੀ ਦੇਣ ਹੈਗੀ ਹੈ ਗੁਰੂ ਅੰਗਦ ਦੇਵ ਜੀ ਦੀ ਦੇਣ ਹੈਗੀ ਹੈ ਸਾਡੀ ਪੰਜਾਬੀ ਭਾਸ਼ਾ ਅਤੇ ਜੇਕਰ ਹਾਲੇ ਦੀ ਗੱਲ ਕਰੀਏ ਹਜੇ ਦੀ ਆਪਾਂ ਗੱਲ ਕਰਦੇ ਹਾਂ ਅਤੇ ਪੰ ਜੇਕਰ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੁਣ ਆਪਾਂ ਦੇਖ ਰਹੇ ਕਾਫੀ ਲੋਕ ਜੇਕਰ ਉਹ ਬਾਹਰ ਜਾਂਦੇ ਨੇ ਤਾਂ ਉਹ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਅਤੇ ਹਿੰਦੀ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਜੇਕਰ ਦੇਖੀਏ ਆਪਾਂ ਅੱਜ ਕੱਲ੍ਹ ਦੀ ਵੀ ਜਿਹੜੀ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਜਿਹੜੀ ਅੱਜ ਕੱਲ੍ਹ ਦੀ ਆਮ ਬੋਲਚਾਲ ਵਿੱਚ ਵੀ ਆਪਣੀ ਪੰਜਾਬੀ ਵਰਤਦੇ ਹਾਂ ਉਹਦਾ ਵਿੱਚ ਵੀ ਕਾਫੀ ਅੰਗਰੇਜ਼ੀ ਦੇ ਅੱਖਰ ਆ ਗਏ ਨੇ ਅਤੇ ਜਿਹਨਾਂ ਵਿੱਚ ਜਿਹਨਾਂ ਕਰਕੇ ਆਪਣੀ ਪੰਜਾਬੀ ਭਾਸ਼ਾ ਵੀ ਪ੍ਰਭਾਵਿਤ ਹੁੰਦੀ ਹੈ ਜੇਕਰ ਸੱਭਿਆਚਾਰ ਦੀ ਗੱਲ ਕਰੀਏ ਅੱਜ ਕੱਲ੍ਹ ਨਵੇਂ ਨਵੇਂ ਸੱਭਿਆਚਾਰ ਜਿਵੇਂ ਅੰਗਰੇਜ਼ੀ ਸੱਭਿਆਚਾਰ ਹੋ ਗਿਆ ਆਪਣਾ ਹਿੰਦੀ ਸੱਭਿਆਚਾਰ ਹੋ ਗਿਆ ਉਹਨਾਂ ਸੱਭਿਆਚਾਰਾਂ ਦੇ ਕਰਕੇ ਵੀ ਆਪਣੀ ਪੰਜਾਬੀ ਹੁਣ ਉਹ ਪ੍ਰੋਪਰ ਪੰਜਾਬੀ ਨਹੀਂ ਰਹੀ ਜੇਕਰ ਆਪਾਂ ਗੱਲ ਕਰਦੇ ਹਾਂ ਆਪਾਂ ਹਿੰਦੀ ਵਿੱਚ ਵੀ ਕਾਫੀ ਚੀਜ਼ਾਂ ਪੰਜਾਬੀ ਦੀ ਵਰਤ ਲੈਂਦੇ ਹਾਂ ਅਤੇ ਉਸੇ ਕਰਕੇ ਹੀ ਆਪਾਂ ਪੰਜਾਬੀ ਦੇ ਵਿੱਚ ਵੀ ਆਪਾਂ ਹਿੰਦੀ ਬਹੁਤ ਜ਼ਿਆਦਾ ਹੀ ਵਰਤ ਲੈਂਦੇ ਹਾਂ ਅਤੇ ਜੇਕਰ ਆਪਾਂ ਦੇਖੀਏ ਤਾਂ ਅੱਜ ਦੀ ਪੰਜਾਬੀ ਅਤੇ ਪੁਰਾਣੀ ਜਿਹੜੀ ਆਪਣੀ ਪੰਜਾਬੀ ਸੀ ਉਹਨਾਂ ਵਿੱਚ ਹੁਣ ਕਾਫੀ ਜ਼ਿਆਦਾ ਫਰਕ ਸਾਨੂੰ ਸਾਫ ਦਿਖਾਈ ਦਿੰਦਾ ਜੋ ਕਿ ਇੱਕ ਚੰਗੀ ਗੱਲ ਨਹੀਂ ਹੈਗੀ